ਹਾਂਜੀ ਬਹੁਤ ਵਧੀਆ ਜੀ ਹੋਰ ਤੁਸੀਂ ਸੁਣਾਓ ਜੀ ਕੀ ਬਣਦਾ ਹਾਂਜੀ ਹਾਂਜੀ ਬਸ ਵਧੀਆ ਮਹਾਰਾਜ ਦਾ ਸ਼ੁਕਰ ਹੈ ਬਸ ਲੰਘੀ ਜਾਂਦਾ ਭਰਾਵਾ ਜਵਾਕ ਹੈ ਨਹੀਂ ਕ ਦੋਨੇ ਜਣੇ ਹਾਂ ਬਸ ਚਲੇ ਜਾਂਦੇ ਉਹ ਤੈਨੂੰ ਪਤਾ ਹੀ ਆ ਕਨੇਡਾ ਸੈੱਟ ਹੈਗੇ ਹਾਂਜੀ ਹਾਂਜੀ ਅਤੇ ਇੱਥੇ ਕਿਹੜਾ ਤੁਹਾਨੂੰ ਪਤਾ ਪੜ੍ਹ ਲਿਖ ਕੇ ਐਵੇਂ ਅਪਸੈਟ ਤੁਰੇ ਫਿਰਦੇ ਬੇਰੁਜ਼ਗਾਰੀ ਐਨੀ ਹੈਗੀ ਉਹ ਫੇਰ ਚੁੱਕਣਾ ਪੈਂਦਾ ਭਾਈ ਹੋਰ ਕਰੀਏ ਕੀ ਹੋਰ ਹਾਂਜੀ ਬਿਲਕੁਲ ਬਿਲਕੁਲ ਦੇਖੋ ਅਸੀਂ ਦੋਨੇ ਜਣੇ ਬਜ਼ੁਰਗ ਸੱਠ ਤੋਂ ਉੱਪਰ ਹੈਗੇ ਉਹ ਬੱਚਿਆਂ ਨੂੰ ਫਿਰ ਬਾਹਰ ਭੇਜੀ ਬੈਠੇ ਹੈਗੇ ਨਾ ਤਾਂ ਇੱਥੇ ਸਰਦਾ ਨਾ ਹੀ ਹੁਣ ਕੰਮ ਕਾਰ ਲਾਏ ਬਿਨਾ ਸਰਦਾ ਹੈਗਾ ਜੇ ਉਹਨਾਂ ਦਾ ਦਾ ਭਵਿੱਖ ਬਣਾਉਣਾ ਹੀ ਹੈ ਨਾ ਹਾਂਜੀ

ਹਾਂ ਹਾਂ ਇਹ ਤਾਂ ਹੈ ਜੀ ਬਸ ਹੁਣ ਕੀਤਾ ਵੀ ਕੀ ਜਾਵੇ ਆਪਣੇ ਕੋਲ ਪੰਜਾਬ ਦੀ ਬੇਰੁਜ਼ਗਾਰੀ ਐਨੀ ਹੋਈ ਪਈ ਹੈ ਐਨੀਆਂ ਪੜ੍ਹ ਲਿਖ ਕੇ ਵੀ ਬੱਚਿਆਂ ਨੂੰ ਜੋਬ ਨਹੀਂ ਮਿਲਦੀ ਅਤੇ ਜੋਬ ਜੇ ਮਿਲਦੀ ਵੀ ਹੈ ਤਾਂ ਛੋਟੀ ਮੋਟੀ ਨੂੰ ਜਵਾਕ ਹੱਥ ਨਹੀਂ ਪਾਉਂਦੇ ਹੈਗੇ ਉਹ ਨਾ ਵੀ ਪੜ੍ਹੇ ਲਿਖੇ ਵੱਧ ਹੈਗੇ ਜੇ ਡਿਗਰੀਆਂ ਕੀਤੀਆਂ ਗਈਆਂ ਹਾਂ ਹੁਣ ਘਰ ਨੂੰ ਵੀ ਐਂ ਲੱਗਦਾ ਵੀ ਜਦ ਐਨੇ ਐਨੇ ਪੜ੍ਹੇ ਲਿਖੇ ਹੈਗੇ ਇੱਥੇ ਇਹੋ ਜਿਹੇ ਕੰਮ 'ਤੇ ਕੀ ਲਾਉਣਾ ਚਲੋ ਫਿਰ ਜਿੱਥੇ ਜਵਾਕਾਂ ਦਾ ਮਨ ਹੈ ਵੀ ਚੱਲ ਵਈ ਆਪਦਾ ਕੰਮ ਹੀ ਕਰਨਾ ਅਸੀਂ ਆਪਦਾ ਹੋਰ ਜੀ ਕੰਮ ਜਿੱਥੇ ਸੈੱਟ ਹੋਵੋਗੇ ਭਾਈ ਹਾਂਜੀ ਹਾਂਜੀ ਹਾਂਜੀ ਹਾਂ ਹਾਂਜੀ ਹਾਂ ਵਧੀਆ ਪੜ੍ਹੇ ਲਿਖੇ ਹਾਂ ਹਾਂ ਹਾਂ ਜ਼ਰੂਰ ਜਦੋਂ ਇੱਧਰ ਆਏ ਨਾ ਦਵਾਈ ਲੈਣ ਆਉਣੀ ਹੈਗੀ ਇੱਧਰ ਹੌਸਪੀਟਲ ਜਾਵਾਂਗੇ ਤਾਂ ਜ਼ਰੂਰ ਤੁ ਤੁਹਾਡੇ ਕੋਲ ਹੋ ਕੇ ਵੀ ਵੀ ਠੀਕ ਹੈ ਜੀ ਨਾ ਨਾ ਕੋਈ ਗੱਲ ਨਹੀਂ ਜੀ ਠੀਕ ਹੈ ਓਕੇ ਸਤਿ ਸ਼੍ਰੀ ਅਕਾਲ